ਭੰਗੜੇ ਵਿੱਚ ਲੁੱਡੀ ਝੂਮਰ ਮੋਰਚਾ ਫੁਲਕਾ ਆਦਿ ਆਮ ਸਟੈਪਸ ਹਨ ਇਹ ਪੰਜਾਬ ਦੇ ਸੱਭਿਆਚਾਰ ਵਿੱਚ ਲੋਕਾਂ ਨ ਮਨੋਰੰਜਨ ਕਰਦੇ ਹਨ ਅਤੇ ਲੋਕਾਂ ਨੂੰ ਖੁਸ਼ ਕਰਦੇ ਹਨ ਅਤੇ ਲ ਇਸ ਇਹ ਹੀ ਸਭ ਕੁਛ ਯੋਗਦਾਨ ਹੈ